ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਤੁਸੀਂ ਬਰਾੜ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਹਾਂਜੀ ਵੀਰੇ ਮੈਂ ਤੁਹਾਡੇ ਨੇੜੇ ਹੀ ਪਿੰਡ ਝੁੰਬਾ ਤੋਂ ਗੱਲ ਕਰ ਰਹੀ ਹਾਂ ਦੋ ਘੰਟੇ ਪਹਿਲਾਂ ਮੇਰਾ ਇੱਕ ਛੋਟਾ ਭਰਾ ਤੁਹਾਨੂੰ ਅੋਡਰ ਦੇ ਕੇ ਗਿਆ ਸੀ ਜਿਸ ਵਿੱਚ ਉਸ ਨੇ ਦਸ ਬਰਗਰ ਦਸ ਪੀਜ਼ੇ ਅਤੇ ਦਸ ਕੋਲਡ ਡਰਿੰਕ ਅੋਡਰ ਕੀਤੀਆਂ ਸਨ ਕਿਉਂਕਿ ਸਾਡੇ ਘਰ ਇੱਕ ਬਰਡੇ ਪਾਰਟੀ ਸੀ ਜਿਸ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਅਤੇ ਸਾਡੇ ਕੁਝ ਦੋਸਤ ਆ ਰਹੇ ਸਨ ਪਰ ਹੁਣ ਸਾਡੇ ਰਿਸ਼ਤੇਦਾਰਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੈ ਜਿਸ ਕਰਕੇ ਉਹ ਹੁਣ ਨਹੀਂ ਆ ਸਕਦੇ ਇਸ ਲਈ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡਾ ਅੋਡਰ ਹੈ ਜਿਹੜਾ ਘੱਟ ਕਰ ਦਿੱਤਾ ਜਾਵੇ ਇਸ ਵਿੱਚ ਪੰਜ ਬਰਗਰ ਪੰਜ ਪੀਜ਼ੇ ਅਤੇ ਪੰਜ ਕੋਲਡ ਡਰਿੰਕ ਕਰ ਦਿੱਤੀਆਂ ਜਾਣ ਅਤੇ ਪੈਸੇ ਸਾਨੂੰ ਰਿਫੰਡ ਕਰ ਦਿੱਤੇ ਜਾਣ ਅਸੀਂ ਤੁਹਾਡੇ ਬਹੁਤ ਹੀ ਜ਼ਿਆਦਾ ਧੰਨਵਾਦੀ ਹੋਵਾਂਗੇ ਕਿਉਂਕਿ ਜੇਕਰ ਅਸੀਂ ਪੂਰਾ ਅੋਡਰ ਮੰਗਵਾਉਂਦੇ ਹਾਂ ਤਾਂ ਇਸ ਵ ਨਾਲ ਖਾਣੇ ਦੀ ਬਹੁਤ ਜ਼ਿਆਦਾ ਬਰਬਾਦੀ ਹੋ ਜਾਵੇਗੀ ਇਸ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਡਾ ਅੋਡਰ ਘਟਾ ਦਿੱਤਾ ਜਾਵੇ ਅਤੇ ਸਾਡੇ ਪੈਸੇ ਵਾਪਸ ਕਰ ਦਿੱਤੇ ਜਾਣ ਧੰਨਵਾਦ